ਓਨਲਾਈਨ ਬੈਂਕਿੰਗ ਕਰਦੇ ਸਮੇਂ ਤੋ ਤੁਹਾਨੂੰ ਬਹੁਤ ਸ ਜ਼ਿਆਦਾ ਸਤਰਕ ਹੋ ਕੇ ਕਰਨਾ ਚਾਹੀਦੀ ਹੈ ਓਨਲਾਈਨ ਬੈਂਕਿੰਗ ਦੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਮਨੁੱਖ ਬਹੁਤ ਤੇਜ਼ੀ ਦੇ ਨਾਲ ਹਰ ਕੰਮ ਕਰਨਾ ਚਾਹੁੰਦਾ ਹੈ ਜਿਸ ਵਿੱਚ ਕਿ ਉਹ ਬੈਂਕਿੰਗ ਵੀ ਨੂੰ ਵੀ ਆ ਆਸਾਨ ਤਰੀਕੇ ਨਾਲ ਯੂਜ਼ ਕਰਨਾ ਚਾਹੁੰਦਾ ਹੈ ਬਟ ਇਹਨਾਂ ਚੀਜ਼ਾਂ ਦੇ ਵਿੱਚ ਖ਼ਤਰਾ ਜ਼ਿਆਦਾ ਵੱਧ ਚੁੱਕਾ ਹੈ ਓਨਲਾਈਨ ਬੈਂਕ ਕਰਦੇ ਸਮੇਂ ਤੁਹਾਨੂੰ ਹਰ ਚੀਜ਼ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਓਨਲਾਈਨ ਬੈਂਕ ਦੇ ਵਿੱਚ ਡਾਇਰੈਕਟ ਅਗਰ ਓਨਲਾਈਨ ਬੈਂਕਿੰਗ ਦੇ ਵਿੱਚ ਤੁਹਾਨੂੰ ਓ ਟੀ ਪੀ ਪਾਸਵਰਡ ਸਾਰੇ ਆਪਣੇ ਹ ਆਪਣੇ ਤੱਕ ਸਤਰਕ ਔਰ ਰੱਖਣੇ ਚਾਹੀਦੇ ਹਨ ਜਿਨ੍ਹਾਂ ਨੂੰ ਫੋਨ ਦੇ ਵਿੱਚ ਸੇਵ ਨਹੀਂ ਕਰਨਾ ਚਾਹੀਦਾ ਹੈ ਓਨਲਾਈਨ ਬੈਂਕਿੰਗ ਨੂੰ ਅਗਰ ਤੁਸੀਂ ਸ ਅ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਬੈਂਕ ਦੇ ਨਾਲ ਸਿੱਧਾ ਉਪਯੋਗ ਕਰੋ ਓਨਲਾਈਨ ਬੈਂਕਿੰਗ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਦੇ ਲਈ ਗਲਤ ਸਾਈਟਾਂ ਦਾ ਉਪਯੋਗ ਨਾ ਕਰੋ ਬੈਂਕਿੰਗ ਖੇਤਰ ਦੇ ਵਿੱਚ ਆਪਣੇ ਪਾਸਵਰਡ ਅਤੇ ਓ ਟੀ ਪੀ ਕਿਸੇ ਵੀ ਵਿਅਕਤੀ ਨੂੰ ਸ਼ੇਅਰ ਨਾ ਕਰੋ ਓਨਲਾਈਨ ਬੈਂਕ ਦੇ ਵਿੱਚ ਤੁਹਾਨੂੰ ਵਰਤੋਂ ਕਰਦੇ ਹੋਏ ਤੁਹਾਨੂੰ ਗਲਤ ਸਾਈਟਾਂ ਦੇ ਤੋਂ ਈਮੇਲਸ ਜਾਂ ਕੋਲਸ ਵੀ ਆਉਂਦੀਆਂ ਹਨ ਜਿਹਨਾਂ ਦੇ ਨਾਲ ਆਪਣਾ ਕੋਈ ਵੀ ਡਾਟਾ ਸ਼ੇਅਰ ਨਹੀਂ ਕਰਨਾ ਚਾਹੀਦਾ ਅਗਰ ਤੁਸੀਂ ਓਨਲਾਈਨ ਬੈਂਕਿੰਗ ਕਰਦੇ ਹੋ ਤਾਂ ਤੁਸੀਂ ਆਪਣੇ ਫੋਨ ਦੇ ਵਿ ਨੂੰ ਅਪਡੇਟ ਰੱਖਿਆ ਹੋਣਾ ਸੋਫਟਵੇਅਰ ਅਪਡੇਟ ਹੋਣੇ ਚਾਹੀਦੇ ਹਨ ਓਨਲਾਈਨ ਬੈਂਕਿੰਗ ਦੇ ਵਿੱਚ ਤੁਸੀਂ ਕਿਸੇ ਵੀ ਵਿਅਕਤੀ ਦੀ ਸਾਈਟ ਤੋਂ ਆਏ ਆਪਣੇ ਆ ਹੈ ਆਇਆ ਹੋਇਆ ਪਾਸਵਰਡ ਜਾਂ ਲਿੰਕ ਕਿਸੇ ਵੀ ਵਿਅਕਤੀ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਹੈ ਓਨਲਾਈਨ ਬੈਂਕਿੰਗ ਕਰਦੇ ਸਮੇਂ ਤੁਹਾਨੂੰ ਬੈਂਕ ਦੇ ਜਿਹੜੀਆਂ ਪਲੇ ਸਟੋਰ ਦੇ ਵਿੱਚ ਬੈਂਕਿੰਗ ਸਾਈਟਸ ਦੇ ਵਿੱਚ ਅਥੋਰਟੀ ਬੈਂਕਿੰਗ ਦੀਆਂ ਸਾਈਟਸ ਹੈਗੀਆਂ ਉਹ ਵੀ ਯੂਜ਼ ਕਰਨੀਆਂ ਚਾਹੀਦੀਆਂ ਹਨ